ਮੈਂ ਔਨਲਾਈਨ ਸ਼ੋਪਿੰਗ ਕੀਤੀ ਮੀਸ਼ੋ ਤੋਂ ਫਸਟ ਟਾਈਮ ਮੈਂ ਮੀਸ਼ੋ ਤੋਂ ਜਿਹੜੀ ਸ਼ੋਪਿੰਗ ਕੀਤੀ ਉਹ ਸੀ ਇੱਕ ਸਾਈਡ ਬੈਗ ਜਿਹਦੇ ਵਿੱਚ ਕਿ ਮੈਂ ਜੋ ਵੀ ਕਲਰ ਬੋਲਿਆ ਉਹ ਹੀ ਕਲਰ ਮਿਲਿਆ ਮੈਨੂੰ ਜਿੰਨੇ ਵੀ ਜਿਹੜੀ ਡੇਟ 'ਤੇ ਉਹਨਾਂ ਨੇ ਕਿਹਾ ਕਿ ਇੰਨੀ ਡੇਟ ਤੱਕ ਤੁਹਾਡੇ ਕੋਲ ਪਹੁੰਚ ਜਾਵੇਗਾ ਉਹ ਹੀ ਡੇਟ 'ਤੇ ਪਹੁੰਚਿਆ ਐਂਡ ਜਿਵੇਂ ਦੀ ਮੈਂ ਚੀਜ਼ ਚਾਹੀ ਉਵੇਂ ਦੀ ਹੀ ਮੈਨੂੰ ਮਿਲੀ ਉਹ ਔਰ ਉਸ ਜਿੰਨੀ ਮਤਲਬ ਜੋ ਚੀਜ਼ ਮੈਂ ਜਿੱਦਾਂ ਦੀ ਚਾਹੁੰਦੀ ਸੀ ਜਿੱਦਾਂ ਦੀ ਮੈਂ ਚਾਹੁੰਦੀ ਸੀ ਐਕਸੈਪਟ ਕਿ ਹਾਂ ਮੈਨੂੰ ਇੱਦਾਂ ਦੀ ਚੀਜ਼ ਮਿਲਦੀ ਉਵੇਂ ਦੀ ਹੀ ਚੀਜ਼ ਮਿਲੀ ਮੈਨੂੰ ਨੀਡ ਉਹਨਾਂ ਦੀ ਜੋ ਸਰਵਿਸ ਆ ਮੈਨੂੰ ਬਹੁਤ ਵਧੀਆ ਲੱਗੀ ਜਿਹਦੇ ਚਲਦੇ ਕਿ ਮੈਂ ਨੈਕਸਟ ਹੋਰ ਬਹੁਤ ਸਾਰੀ ਔਨਲਾਈਨ ਸ਼ੋਪਿੰਗ ਕੀਤੀ ਕੀ ਤਾਂ ਕਿ ਮੈਨੂੰ ਐਵੇਂ ਦੀ ਸਰਵਿਸ ਦੁਬਾਰਾ ਮਿਲੇ ਅਤੇ ਮੈਂ ਇਵੇਂ ਦੇ ਮਤਲਬ ਜੋ ਵੀ ਹੈ ਮੇਰੀ ਔਨਲਾਈਨ ਸ਼ੋਪਿੰਗ ਵਧੀਆ ਚੱਲ ਰਹੀ ਸੀ ਐਂਡ ਉਸ ਤੋਂ ਬਾਅਦ ਅਗਰ ਕੋਈ ਚੀਜ਼ ਮੈਨੂੰ ਮੰਨ ਲਓ ਨੀਡ ਹੈ ਉਸ ਤੋਂ ਬਾਅਦ ਮੈਂ ਉਹਨੂੰ ਕੈ ਮਤਲਬ ਰਿਟਰਨ ਵੀ ਕੀਤਾ ਉਸ ਦੇ ਲਈ ਮੈਨੂੰ ਕੈਸ਼ ਬੈਕ ਵੀ ਆਇਆ